ਮੈਂ ਗੁਰਦੀਪ ਕੌਰ ਬੋਲ ਰਹੀ ਹਾਂ ਤੁਸੀਂ ਖਾਲਸਾ ਟੈਕਸੀ ਸਟੈਂਡ ਤੋਂ ਬੋਲ ਰਹੇ ਹੋ ਮੈਂ ਇੱਕ ਕੈਬ ਬੁੱਕ ਕਰਨੀ ਆ ਜੋ ਕਿ ਮੈਂ ਚੰਡੀਗੜ੍ਹ ਪੀ ਜੀ ਆਈ ਜਾਣਾ ਹੈ ਜਿਸ ਵਿੱਚ ਮੇਰੇ ਮਾਤਾ ਜੀ ਅਤੇ ਨਵਾਂਸ਼ਹਿਰ ਤੋਂ ਮੇਰੇ ਭਾਬੀ ਜੀ ਅਤੇ ਬਲਾਚੌਰ ਤੋਂ ਮੇਰੀ ਭੈਣ ਵੀ ਨਾਲ ਜਾਵੇਗੀ ਜਿਸ ਕਰਕੇ ਅਸੀਂ ਅੱਗੇ ਵੀ ਤੁਹਾਡੀ ਹੀ ਜਗ੍ਹਾ ਇੱਥੋਂ ਕੈਬ ਬੁੱਕ ਕਰਕੇ ਜਾਂਦੇ ਹਾਂ ਇਹ ਮੈਨੂੰ ਦੱਸ ਦਿਉ ਕਿ ਤੁਸੀਂ ਕਿੰਨੇ ਪੈਸੇ ਲਓਗੇ ਉੱਥੇ ਜਾਣ ਦੇ ਤਾਂ ਕਿ ਸਾਨੂੰ ਉੱਥ ਉੱਥੇ ਜਾਣ ਵਿੱਚ ਕੋਈ ਪ੍ਰੋਬਲਮ ਨਾ ਆਵੇ ਅਤੇ ਡਰਾਈਵਰ ਦੇ ਬਾਰੇ ਵੀ ਸਾਨੂੰ ਦੱਸ ਦਿਉ ਕਿ ਰਸਤੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਮੈਂ ਤੁਹਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਸਹੀ ਟਾਈਮ 'ਤੇ ਉਹ ਉੱਥੇ ਪਹੁੰਚਾ ਦੇਣ ਅਤੇ ਮੈਂ ਉਹਨਾਂ ਦੀ ਖਬਰ ਲੈ ਕੇ ਆਪਣੇ ਵਾਪਸ ਜਿਹੜੇ ਨਾਲ ਸਾਡੇ ਗਏ ਹੋਣ ਉਹਨਾਂ ਨੂੰ ਵੀ ਵਾਪਸ ਉਸ ਜਗ੍ਹਾ 'ਤੇ ਛੱਡਣਾ ਹੈ ਜਿਵੇਂ ਨਵਾਂਸ਼ਹਿਰ ਅਤੇ ਰੋਪੜ ਵੀ ਛੱਡਣਾ ਹੈ ਤੁਸੀਂ ਮੈਨੂੰ ਇਹ ਦੱਸ ਦਿਉ ਕਿ ਇਸ ਦਾ ਕੀਮਤ ਕਿੰਨੀ ਹੋਵੇਗੀ ਉੱਥੇ ਜਾਣ ਦੀ